ਮੈਂ ਆਪਣੇ ਦੋਸਤ ਨੂੰ ਫ਼ੋਨ ਕਰਕੇ ਕਿਹਾ ਹੈਲੋ ਯਾਰ ਮੈਂ ਆਪਣੇ ਉਮੀਦ ਟੀਮ ਆਈਡੀ ਨੂੰ ਅਪਡੇਟ ਕਰ ਲਿਆ ਹੈ ਅਤੇ ਹੁਣ ਮੈਂ ਆਪਣੇ ਡਿਜੀਲੋਕਰ ਖਾਤੇ ਵਿੱਚ ਨਵਾਂ ਮੋਬਾਈਲ ਨੰਬਰ ਅਪਡੇਟ ਕਰਨਾ ਚਾਹੁੰਦਾ ਹਾਂ ਪਰ ਮੈਨੂੰ ਪਤਾ ਨਹੀਂ ਕਿ ਇਹ ਚੋਣ ਸੈਟਿੰਗ ਕਿੱਥੇ ਵਿੱਚ ਕਿੱਥੇ ਮਿਲੇਗੀ ਮੇਰਾ ਏ ਦੋ ਕਿੱਥੇ ਮਿਲੇਗੀ ਇਸ ਕਰਕੇ ਮੈਨੂੰ ਤੂੰ ਮੇਰੀ ਥੋੜ੍ਹੀ ਮਦਦ ਕਰ ਦੇ ਫਿਰ ਮੇਰੇ ਦੋਸਤ ਤੂੰ ਪ੍ਰੋਫ਼ਾਈਲ ਸੈਟਿੰਗ ਦੇ ਵਿੱਚ ਜਾ ਕੇ ਓਪਸ਼ਨ ਹੈ ਉੱਥੇ ਚੇਂਜ ਮੋਬਾਈਲ ਨੰਬਰ ਦਾ ਵਿਕਲਪ ਹੋਣ ਦੀ ਸੰਭਾਵਨਾ ਹੈ ਮੈਂ ਕਹਿੰਦਾ ਹਾਂ ਠੀਕ ਹੈ ਮੈਂ ਹੁਣੇ ਹੀ ਪ੍ਰੋਫਾਈਲ ਸੈਟਿੰਗ ਚੈੱਕ ਕਰਦਾ ਹਾਂ ਜੇਕਰ ਨਾ ਮਿਲੀ ਤਾਂ ਹੋਰ ਵੀ ਪਤਾ ਕਰ ਲਵਾਂਗਾ ਧੰਨਵਾਦ ਯਾਰ ਤੂੰ ਮੇਰੀ ਇੰਨੀ ਮਦਦ ਕਰਦਾ ਹਾਂ ਪਰ ਮੈਂ ਤੇਰੀ ਅੱਗੇ ਆ ਕੇ ਤੈਨੂੰ ਕਿਤੇ ਵੀ ਲੋੜ ਪਵੇ ਤਾਂ ਮੈਂ ਵੀ ਤੇਰੀ ਮਦਦ ਕਰਾਂਗਾ ਅਤੇ ਅੱਗੇ ਜਾ ਕੇ ਧੰਨਵਾਦ